ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਮੇਰੇ ਅਧਿਆਪਕ ਨੇ ਤੁਹਾਡਾ ਨੰਬਰ ਦਿੱਤਾ ਸੀ ਵੀ ਤੁਸੀਂ ਇੱਥੇ ਮੋਹਾਲੀ ਦੇ ਲੌਕਲ ਹੋ ਮੈਂ ਪਟਿਆਲੇ ਤੋਂ ਇੱਥੇ ਆਪਣੇ ਮੋਹਾਲੀ ਆਉਣਾ ਹੈ ਜੀ ਮੇਰੇ ਸਕੂਲ ਦੇ ਸਰਟੀਫਿਕੇਟ ਦੇ ਵਿੱਚ ਨਾਮ ਗਲਤ ਹੈ ਉਹ ਠੀਕ ਕਰਵਾਉਣ ਆਉਣਾ ਹੈ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਆਪਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਇਮਾਰਤ ਮੋਹਾਲੀ 'ਚ ਕਿੱਥੇ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਾਮ ਠੀਕ ਕਰਵਾਉਣਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਇਸ ਨੰਬਰ 'ਤੇ